ਹੈਲੋ ਰਾਮ ਰਾਮ ਸਰ ਜੀ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਮੈਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਤੁਹਾਡੀ ਟਰੈਵਲ ਏਜੰਸੀ ਤੋਂ ਇੱਕ ਕਾਰ ਬੁਕ ਕਰਵਾਈ ਸੀ ਜੋ ਕਿ ਸਾਡਾ ਘੁੰਮਣ ਦਾ ਪਲੈਨ ਅੰਮ੍ਰਿਤਸਰ ਦਾ ਸੀ ਮੈਨੂੰ ਤੁਹਾਡੇ ਕੋਲੋਂ ਇੱਕ ਕਾਰ ਚਾਹੀਦੀ ਸੀ ਨਾਲ ਹੀ ਡਰਾਈਵਰ ਕਾਰ ਅਤੇ ਡਰਾਈਵਰ ਦੋਨੋ ਅੱਛੇ ਸੀ ਸਾਨੂੰ ਉਹਨੇ ਬੜੇ ਹੀ ਰੀਝ ਨਾਲ ਸਾਨੂੰ ਹਰਿਮੰਦਰ ਸਾਹਿਬ ਘੁੰਮਾਇਆ ਜੋ ਕਿ ਡਰਾਈਵਰ ਬੜੀ ਅੱਛੀ ਤਰ੍ਹਾਂ ਗੱਡੀ ਚਲਾਉਂਦਾ ਸੀ ਉਸਨੇ ਡਰਾਈਵਰੀ ਦੇ ਸਾਰੇ ਹੁਨਰ ਸਨ ਜੋ ਕਿ ਗੱਡੀ ਬੜੇ ਸੂਝ ਬੂਝ ਨਾਲ ਚਲਾ ਰਿਹਾ ਸੀ ਉਸ ਦੇ ਗੱਡੀ ਦੇ ਸਾਰੇ ਡਾਕੂਮੈਂਟ ਪੂਰੇ ਸਨ

ਉਸ ਨਾਲ ਜਾ ਕੇ ਸਾਨੂੰ ਕੋਈ ਵੀ ਬੇਗਾਨਿਆ ਜੈਸਾ ਵਹਿਰਾਵਾ ਨਜ਼ਰ ਨਹੀਂ ਆਇਆ ਉਹ ਕਿ ਇੱਕ ਘਰ ਦੇ ਮੈਂਬਰ ਜੈਸਾਂ ਹੀ ਸਾਡੇ ਨਾਲ ਘੁੰਮਦਾ ਰਿਹਾ ਕੋਸ਼ਿਸ਼ ਕਰਨਾ ਕਿ ਅੱਗੇ ਤੋਂ ਸਾਨੂੰ ਜੋ ਵੀ ਦੁਬਾਰਾ ਗੱਡੀ ਦੀ ਜ਼ਰੂਰਤ ਪਵੇ ਤਾਂ ਸਾਨੂੰ ਇੱਦਾਂ ਦਾ ਹੀ ਡਰਾਈਵਰ ਮਿਲੇ